ਹੈਲੋ ਹਾਂਜੀ ਇਹ ਕਮਲ ਡੇਰੀ ਦਾ ਨੰਬਰ ਹੈ ਮੈਂ ਦੁੱਧ ਬਾਰੇ ਪੁੱਛਣਾ ਸੀ ਮੈਂ ਸ਼ਮਸ਼ੇਰ ਅੰਗੀ ਬੋਲਦਾ ਪਿਆ ਇੱਥੋਂ ਕਾਲਕਾ ਮੰਦਰ ਕੋਲ ਮੇਰਾ ਘਰ ਹੈ ਅਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਮਲ ਡੇਰੀ 'ਤੇ ਬਹੁਤ ਅੱਛੇ ਪ੍ਰੋਡਕਟ ਮਿਲਦੇ ਨੇ ਤੁਸੀਂ ਆਪ ਡੇਰੀ ਆਪਣੇ ਸੰਚਾਲਕ ਹੋ ਅੱਛਾ ਅੱਛਾ ਅੱਛਾ ਮੈਂ ਪੁੱਛਣਾ ਸੀ ਤੁਹਾਡੇ ਕੋਲ ਡੇਰੀ ਦੇ ਕੀ ਕੀ ਪ੍ਰੋਡਕਟ ਮਿਲਦੇ ਨੇ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਦੁੱਧ ਕਿਹੜੀ ਕਿਹੜੀ ਕਾ ਕੰਪਨੀ ਦਾ ਆਉਂਦਾ ਤੁਹਾਡੇ ਕੋਲ ਅਤੇ ਫਰੈਸ਼ ਦੁੱਧ ਵੀ ਮਿਲ ਜਾਂਦਾ ਅੱਛਾ ਵੈਸੇ ਮੋਟੇ ਤੌਰ 'ਤੇ ਰੇਟ ਕੀ ਨੇ ਇਹਦਾ ਕੀ ਰੇਟ ਹੈ ਅਮੁਲ ਪ ਪੈਕਟ ਵਾਲੇ ਦਾ ਅੱਛਾ ਅਤੇ ਦੂਸਰਾ ਜਿਹੜਾ ਅੱਛਾ ਅੱਛਾ ਅੱਛਾ ਅੱਛਾ ਅਤੇ ਜਿਹੜਾ ਬਾਕੀ ਉਹ ਪਨੀਰ ਪਨੀਰ ਵਗੈਰਾ ਅੱਛਾ ਪਨੀਰ ਕੀ ਰੇਟ ਹੈ ਅਤੇ ਦੁੱਧ ਡੇਲੀ ਫਰੈਸ਼ ਆਉਂਦਾ ਤੁਹਾਡੇ ਕੋਲ ਅਤੇ ਬਾਕੀ ਦੁੱਧ ਬਾ ਡੇਲੀ ਫਰੈਸ਼ ਆਉਂਦਾ ਠੀਕ ਹੈ ਠੀਕ ਹੈ ਘਿਓ ਪਨੀਰ ਤਾਂ ਜਦੋਂ ਜ਼ਰੂਰਤ ਹੋਵੇਗੀ ਤੁਹਾਡੇ ਕੋਲ ਆ ਕੇ ਲੈ ਲਾਵਾਂਗੇ ਪਰ ਸਾਨੂੰ ਤੁਸੀਂ ਦੁੱਧ ਜਿਹੜਾ ਸਾਨੂੰ ਡੇਲੀ ਚਾਹੀਦਾ ਹੁੰਦਾ ਤੁਹਾਨੂੰ ਤੁਸੀਂ ਸਾਨੂੰ ਸਪਲਾਈ ਕਰ ਸਕਦੇ ਹੋ ਘਰ ਕਾਲਕਾ ਮੰਦਰ ਕੋਲ ਘਰ ਹੈ ਦੇਖੋ ਅਸੀਂ ਮੈਂ ਘਰ ਨਹੀਂ ਰਹਿੰਦਾ ਸਵੇਰੇ ਮੈਂ ਜੋਬ 'ਤੇ ਜਾਣਾ ਹੁੰਦਾ ਮੈਂ ਸਵੇਰੇ ਮਤਲਬ ਅੱਠ ਵਜੇ ਘਰੋਂ ਅੱਠ ਨੌਂ ਵਜੇ ਘਰੋਂ ਨਿਕਲਣਾ ਹੁੰਦਾ ਰਾਤ ਨੂੰ ਲੇਟ ਆਈ ਦਾ ਸਵੇਰੇ ਅਗਰ ਸਾਡਾ ਮਤਲਬ ਡਿਲੀਵਰੀ ਮੈਨ ਸਾਨੂੰ ਉੱਥੇ ਘਰ ਦੁੱਧ ਦੇ ਜਾਵੇ ਦੋ ਲੀਟਰ ਤਿੰਨ ਲੀਟਰ ਮੈਂ ਦੱਸ ਦਿਆਂਗਾ ਤੁਹਾਨੂੰ ਅਤੇ ਤੁਸੀਂ ਅਗਰ ਉਹ ਪੁਜਾ ਸਕਦੇ ਹੋ

ਅੱਛਾ ਕਿੰਨੇ ਵਜੇ ਆ ਜਾਂਦੇ ਦੁੱਧ ਡੇਲੀ ਸਾਢੇ ਅੱਠ ਤੋਂ ਸਾਢੇ ਅੱਠ ਤੱਕ ਮਤਲਬ ਮਿਲ ਜਾਏ ਤਾਂ ਵਧੀਆ ਅੱਛਾ ਅੱਛਾ ਅੱਛਾ ਅਤੇ ਮਤਲਬ ਉਹ ਡੇਲੀ ਫਰੈਸ਼ ਹੁੰਦਾ ਅਤੇ ਡੇਟ ਵਗੈਰਾ ਲਿਖੀ ਹੁੰਦੀ ਦੁੱਧ ਦੀ ਉਹ 'ਤੇ ਐਕਸਪਾਇਰੀ ਡੇਟ ਦਹੀਂ ਪਨੀਰ ਅਤੇ ਜੋ ਉਹ ਤਾਂ ਫਿਰ ਤੁਹਾਨੂੰ ਫੋਨ 'ਤੇ ਦੱਸ ਦਾਂਗੇ ਕੋਈ ਚੀਜ਼ ਚਾਹੀਦੀ ਹੋਈ ਲੇਕਿਨ ਦੁੱਧ ਤਾਂ ਸਾਨੂੰ ਪਰਮਾਨੈਂਟ ਡੇਲੀ ਚਾਹੀਦਾ ਦੋ ਲੀਟਰ ਦੋ ਲੀਟਰ ਸ ਅ ਦੋ ਲੀਟਰ ਸਵੇਰੇ ਦੋ ਲੀਟਰ ਸ਼ਾਮ ਨੂੰ ਸ਼ਾਮ ਨੂੰ ਤੁਸੀਂ ਜਦੋਂ ਵੀ ਆਉਂਦਾ ਚਲੋ ਸੱਤ ਅੱਠ ਵਜੇ ਤੋਂ ਬਾਅਦ ਜਦੋਂ ਮਰਜ਼ੀ ਭੇਜ ਦਿਓ ਅਤੇ ਪੇਮੈਂਟ ਦਾ ਕਿਵੇਂ ਤੁਹਾਨੂੰ ਕੈਸ਼ ਚਾਹੀਦੀ ਆ ਜਾਂ ਕਿ ਉਹ ਮਤਲਬ ਡਿਲੀਵਰੀ ਮੈਨ ਨੂੰ ਦੇ ਦੇਈਏ ਜਾਂ ਤੁਹਾਨੂੰ ਅਸੀਂ ਉਹ ਇਕੱਠਾ ਆ ਕੇ ਗੂਗਲ ਪੇ ਕਰ ਦੇਈਏ ਦੁੱਧ ਦੀ ਗਰੰਟੀ ਕੀ ਹੈ ਵਧੀਆ ਦੁੱਧ ਹੈ ਫਰੈਸ਼ ਬਿਲਕੁਲ ਅੱਛਾ ਅੱਛਾ ਅੱਛਾ ਅੱਛਾ ਅੱਛਾ ਹੋਰ ਕੀ ਮਿਲਦਾ ਕਰੀਮ ਅਤੇ ਸ਼ੁੱਧ ਦੇਸੀ ਘਿਓ ਅਤੇ ਪਨੀਰ ਦੁੱਧ ਅੱਛਾ ਅੱਛਾ ਅੱਛਾ ਅਤੇ ਜਿਹੜਾ ਤੁਹਾਡੇ ਕੋਲ ਫਰੈਸ਼ ਦੁੱਧ ਆਉਂਦਾ ਹੈ ਉਹ ਮਤਲਬ ਉਹ ਉਹਦਾ ਕੀ ਰੇਟ ਹੈ ਅੱਛਾ ਅੱਛਾ ਜਿਹੜਾ ਉਹ ਗਾਂ ਦਾ

ਪਰ ਆਪਾਂ ਨੂੰ ਪੈਕਟ ਵਾਲਾ ਹੀ ਠੀਕ ਹੈ ਅਗਰ ਸਾਨੂੰ ਤੁਸੀਂ ਉਹ ਅਮੁਲ ਦਾ ਦੇ ਦਿਓ ਚਾਹੇ ਤੁਸੀਂ ਸਾਨੂੰ ਦਾ ਦੇ ਦਿਓ ਕੋਈ ਜਿਹੜਾ ਅੱਛਾ ਹੈ ਉਹ ਤੁਸੀਂ ਭਿਜਵਾ ਦਿਆ ਕਰੋ ਚਲੋ ਤੁਸੀਂ ਵ ਕੱਲ੍ਹ ਤੋਂ ਸ਼ੁਰੂ ਕਰ ਦਿਓ ਸਵੇਰੇ ਅੱਠ ਵਜੇ ਤੱਕ ਸਾਢੇ ਅੱਠ ਤੱਕ ਸਵੇਰੇ ਦੋ ਲੀਟਰ ਉਹ ਅਤੇ ਦੋ ਲੀਟਰ ਸ਼ਾਮ ਨੂੰ ਬਾਕੀ ਪ੍ਰੋਡਕਟ ਬਾਰੇ ਮੈਂ ਤੁਹਾਨੂੰ ਕਾਲ ਕਰਦਾ ਦਿੰਦਾ ਠੀਕ ਹੈ ਜੀ ਥੈਂਕ ਯੂ ਜੀ